ਸਤਿ ਸ਼੍ਰੀ ਅਕਾਲ ਜੀ ਮੈਂ ਦਵਿੰਦਰ ਕੌਰ ਗੱਲ ਕਰ ਰਹੀ ਹਾਂ ਕੀ ਮੇਰੀ ਗੱਲ ਸ਼ਿਵ ਮੋਟਰਸ ਦੇ ਮੈਨੇਜਰ ਨਾਲ਼ ਹੋ ਰਹੀ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਤੁਹਾਡੀ ਬਹੁਤ ਹੀ ਪੁਰਾਣੀ ਗਾਹਕ ਹਾਂ ਮੈਂ ਅੱਗੇ ਵੀ ਤੁਹਾਡੇ ਇੱਥੋਂ ਕੈਬ ਬੁੱਕ ਕਰਦੀ ਰਹਿੰਦੀ ਹਾਂ ਮੈਂ ਪਰਸੋਂ ਮੋਹਾਲੀ ਤੋਂ ਅੰਮ੍ਰਿਤਸਰ ਤੱਕ ਦੀ ਕੈਬ ਬੁੱਕ ਕੀਤੀ ਸੀ ਉੱਥੇ ਮੇਰਾ ਕੁਝ ਫੈਮਲੀ ਫੰਕਸ਼ਨ ਸੀ ਪਰ ਮੈਨੂੰ ਔਫਿਸ ਵਿੱਚ ਇੱਕ ਜ਼ਰੂਰੀ ਕੰਮ ਆ ਗਿਆ ਹੈ ਜਿਸ ਕਾਰਨ ਮੈਂ ਫੰਕਸ਼ਨ 'ਤੇ ਨਹੀਂ ਜਾ ਸਕਦੀ ਇਸ ਲਈ ਮੈਂ ਜੋ ਕੈਬ ਬੁੱਕ ਕੀਤੀ ਸੀ ਉਹ ਰੱਦ ਕਰਨਾ ਚਾਹੁੰਦੀ ਹਾਂ ਅਤੇ ਕੈਬ ਬੁਕਿੰਗ ਲਈ ਮੈਂ ਜੋ ਤੁਹਾਨੂੰ ਅੱਧੀ ਪੇਮੈਂਟ ਪੇ ਕੀਤੀ ਹੋਈ ਸੀ ਮੈਂ ਉਹ ਵੀ ਵਾਪਸ ਲੈਣਾ ਚਾਹੁੰਦੀ ਹਾਂ ਮੈਂ ਪੇਮੈਂਟ ਵਾਪਸ ਲੈਣ ਲਈ ਤੁਹਾਡੇ ਔਫਿਸ ਨਹੀਂ ਆ ਸਕਦੀ ਕਿਉਂਕਿ ਮੈਨੂੰ ਔਫਿਸ ਵਿੱਚ ਜ਼ਰੂਰੀ ਕੰਮ ਹੈ ਹੁਣ ਕੀ ਤੁਸੀਂ ਮੈਨੂੰ ਮੇਰੀ ਪੇਮੈਂਟ ਯੂ ਪੀ ਆਈ ਦੁਆਰਾ ਸੈਂਡ ਕਰ ਸਕਦੇ ਹੋ ਮੈਂ ਤੁਹਾਨੂੰ ਆਪਣਾ ਗੂਗਲ ਪੇ ਨੰਬਰ ਅੱਠ ਛੇ ਨੌ ਨੌ ਛੇ ਚਾਰ ਨੌ ਨੌ ਸੱਤ ਦੋ ਭੇਜ ਰਹੀ ਹਾਂ ਕਿਰਪਾ ਕਰਕੇ ਤੁਸੀਂ ਮੈਨੂੰ ਇਸ ਨੰਬਰ ਉੱਤੇ ਮੇਰੀ ਪੇਮੈਂਟ ਵਾਪਸ ਕਰ ਦਿਓ ਧੰਨਵਾਦ